ਹੈਲੋ ਸਤਿ ਸ਼੍ਰੀ ਅਕਾਲ ਜੀ ਹਾਂਜੀ ਮੈਮ ਦੱਸੋ ਓਕੇ ਜੀ ਹਾਂਜੀ ਮੈਮ ਜੇਕਰ ਤੁਸੀਂ ਅੰਮ੍ਰਿਤਸਰ ਵੱਲ ਜਾਣਾ ਗਾ ਤਾਂ ਉਸ ਪਾਸੇ ਟਰੇਨਾਂ ਥੋੜ੍ਹਾ ਜਿਹਾ ਡਿਲੇਅ ਚੱਲ ਰਹੀਆਂ ਜੀ ਤੇ ਉਹਦੇ ਕਿਸਾਨਾਂ ਕਰਕੇ ਧਰਨੇ ਲੱਗੇ ਪਏ ਆ ਅਤੇ ਇਹਨਾਂ ਟਰੈਕ ਵਗੈਰਾ ਬੰਦ ਕਰ ਰੱਖੇ ਹੈਗੇ ਆ ਤੁਸੀਂ ਇੱਦਾਂ ਕਰੋ ਤੁਸੀਂ ਪਹਿਲਾਂ ਇੱਧਰ ਅਨੰਦਪੁਰ ਸਾਹਿਬ ਨੂੰ ਨਿਕਲ ਜਾਓ ਇਸ ਪਾਸੇ ਟਰੇਨਾਂ ਚੱਲ ਰਹੀਆਂ ਨੇ ਜੀ ਹਾਂ ਅਨੰਦਪੁਰ ਸਾਹਿਬ ਜੀ ਬ ਆਪਣਾ ਬਾਇਆ ਅੰਬਾਲਾ ਹੋ ਕੇ ਜਾਣਾ ਪੈਂਦਾ ਜੀ ਤੁਹਾਨੂੰ ਆਪਾਂ ਨੇ ਤੁਹਾਨੂੰ ਟਰੇਨ ਮਿਲਣੀ ਆ ਅੰਬਾਲੇ ਦੀ ਅਤੇ ਉੱਥੋਂ ਤੁਹਾਨੂੰ ਡਰੈਕਟ ਸਿੱਧੀ ਅਨੰਦਪੁਰ ਸਾਹਿਬ ਦੀ ਮਿਲ ਜਾਣੀ ਹੈ ਜੀ ਅਤੇ ਨਹੀਂ ਨਹੀਂ ਹਾਂਜੀ ਇਹ ਆਪਣੇ ਨਹੀਂ ਨਹੀਂ ਇਹ ਆਪਣੇ ਪੂਰੇ ਟਾਈਮ ਚੱਲਦੀ ਆ ਟ੍ਰੇਨ ਜੀ ਇਹ ਲੇਟ ਹੈ ਨਹੀਂ ਜੀ ਉਸ ਟਾਈਮ ਉਸ ਪਾਸੇ ਦਾ ਟਰੈਕ ਬਿਲਕੁਲ ਕਲੀਅਰ ਹੈਗਾ ਪਰ ਇਸ ਪਾਸੇ ਥੋੜ੍ਹਾ ਜਿਹਾ ਦਿੱਕਤ ਆ ਰਹੀ ਆ ਸਾਨੂੰ ਜੀ ਟ੍ਰੇਨਾਂ ਕੁਛ ਕੈਂਸਲ ਵੀ ਹੋ ਰਹੀਆਂ ਅਤੇ ਡਿਲੇਅ ਵੀ ਹੋ ਰਹੀਆਂ ਜੀ ਅਨੰਦਪੁਰ ਸਾਹਿਬ ਨੂੰ ਨਿਕਲੋ ਹਾਂਜੀ ਹਾਂਜੀ ਸੈਟਰਡੇ ਜਾਓ ਟਿਕਟ ਬੁੱਕ ਕਰ ਲਓ ਆਪਣੀ